ਮੈਂ ਸ਼ੀਤਲ ਵਾਸੀ ਮਿਰਜ਼ਾਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਇਲਾਕੇ ਵਿੱਚ ਔਰਤਾਂ ਨੂੰ ਕੰਮ ਕਰਨ ਲਈ ਕਿਤੇ ਬਾਹਰ ਜਾਣਾ ਪੈਂਦਾ ਹੈ ਤਾਂ ਉਸ ਸਮੇਂ ਦੇ ਮੁਤਾਬਕ ਖੁੱਲ੍ਹ ਕੇ ਬਾਹਰ ਨਹੀਂ ਜਾ ਸਕਦੀਆਂ ਪਰ ਅੱਜ ਸਮਾਂ ਬਦਲ ਗਿਆ ਹੈ ਔਰਤ ਕਿਸੇ ਗੱਲੋਂ ਵੀ ਘੱਟ ਨਹੀਂ ਹਨ ਉਹ ਹਰ ਕੰਮ ਕਰਨ ਵਾਸਤੇ ਅੱਗੇ ਹੋ ਜਾਂਦੀਆਂ ਹਨ ਅੱਜ ਸਮਾਂ ਅਜਿਹਾ ਆ ਗਿਆ ਹੈ ਕਿ ਅਸੀਂ ਆਪਣੇ ਇਲਾਕੇ ਵਿੱਚ ਕਈ ਔਰਤਾਂ ਨੂੰ ਬੈਟਰੀ ਵਾਲੇ ਰਿਕਸ਼ੇ ਚਲਾਉਂਦੇ ਵੇਖਿਆ ਹੈ ਜੋ ਇੱਕ ਗਾਹਕ ਵਾਧੂ ਸੋਚਦਾ ਹੈ ਕਿ ਔਰਤ ਵੀ ਇੱਕ ਕੰਮ ਕਰ ਸਕਦੀਆਂ ਹਨ ਜਾਂ ਆਮ ਅਸੀਂ ਦੇਖਿਆ ਕਿ ਔਰਤਾਂ ਕਾਰਾਂ ਵੀ ਚਲਾਉਂਦੀਆਂ ਹਨ ਔਰਤ ਦੀ ਜੇਕਰ ਅਸੀਂ ਗੱਲ ਦੇ ਸਮੇਂ ਵਿੱਚ ਮੰਗ ਕਰੀਏ ਤਾਂ ਉਹ ਸਾਰੇ ਕੰਮ ਕਰਨ ਵਾਸਤੇ ਤਿਆਰ ਹਨ ਅੱਜ ਇੱਕ ਔਰਤ ਜਹਾਜ਼ ਵੀ ਚਲਾਉਂਦੀ ਹੈ ਟਰੇਨ ਵੀ ਚਲਾਉਂਦੀ ਹੈ ਅਤੇ ਕੋਈ ਵੀ ਕੰਮ ਅਜਿਹਾ ਨਹੀਂ ਹੈ ਜੋ ਔਰਤ ਨਹੀਂ ਕਰਦੀ ਪਰ ਕੁਝ ਖੇਤਰ ਅਜਿਹੇ ਹਨ ਜਿਹਨਾਂ ਵਿੱਚ ਔਰਤ ਕੰਮ ਕਰਨ ਨੂੰ ਕੰਮ ਤੋਂ ਸ਼ਰਮ ਮਹਿਸੂਸ ਕਰਦੀਆਂ ਹਨ ਅਤੇ ਉਹ ਗਰਵਾਦੀਆਂ ਹਨ ਕਿ ਡਰਦੀਆਂ ਹਨ ਕਿ ਸਾਡਾ ਸਮਾਜ ਸਾਨੂੰ ਇਹ ਇਹਨਾਂ ਕੰਮਾਂ ਦੀ ਇਜਾਜ਼ਤ ਨਹੀਂ ਦਿੰਦਾ ਪਰ ਅਜਿਹਾ ਨਹੀਂ ਹੈ ਮੈਂ ਦੱਸਣਾ ਚਾਹੁੰਦੀ ਹਾਂ ਕਿ ਅੱਜ ਔਰਤ ਦੀ ਸਮਾਜ ਵਿੱਚ ਭੂਮਿਕਾ ਬਦਲ ਚੁੱਕੀ ਹੈ ਹਰ ਔਰਤ ਨੂੰ ਵੱਧ ਤੋਂ ਵੱਧ ਹਰ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਔਰਤ ਪੜ੍ਹ ਲਿਖ ਗਈ ਅਤੇ ਉਹ ਕਿਸੇ ਦੇ ਮੁਹਤਾਜ਼ ਨਹੀਂ ਹੈ ਇਸ ਕਰਕੇ ਉਸਨੂੰ ਸਮੇਂ ਦੇ ਲਿਹਾਜ਼ ਨਾਲ ਵੱਧ ਤੋਂ ਵੱਧ ਕੰਮ ਕਰਕੇ ਅਤੇ ਅੱਗੇ ਪਹੁੰਚਣਾ ਇੱਕ ਵਧੀਆ ਕੰਮ ਹੈ ਧੰਨਵਾਦ ਜੀ